ਸਤਿ ਸ਼੍ਰੀ ਅਕਾਲ ਮੇਰਾ ਨਾਮ ਪ੍ਰਿਆ ਹੈ ਅਤੇ ਮੇਰਾ ਪਸੰਦੀਦਾ ਅਭਿਨੇਤਾ ਦਿਲਜੀਤ ਦੁਸਾਂਝ ਹੈ ਜੋ ਕਿ ਪਹਿਲਾਂ ਇੱਕ ਅਭਿਨੇਤਾ ਨਾ ਹੋ ਕੇ ਇੱਕ ਸਿੰਗਰ ਸਨ ਅਤੇ ਸਿੰਗਰ ਹੁੰਦੇ ਹੋਏ ਹੀ ਉਹਨਾਂ ਨੇ ਸ਼ੌਹਰਤ ਦੌਲਤ ਨੂੰ ਹਾਸਲ ਕੀਤਾ ਅਤੇ ਹੁਣ ਉਹ ਇੱਕ ਸਿੰਗਰ ਹੋਣ ਦੇ ਨਾਲ ਨਾਲ ਅਭਿਨੇਤਾ ਵੀ ਹਨ ਉਹਨਾਂ ਦੀ ਹੁਣੇ ਇੱਕ ਦੋ ਨਵੀਆਂ ਫਿਲਮਾਂ ਆਈਆਂ ਹਨ ਜਿਵੇਂ ਕਿ ਚਮਕੀਲਾ ਅਤੇ ਕ੍ਰਿਯੂ ਇਹਨਾਂ ਇਹ ਦੋਨੋਂ ਆਫਿਸ 'ਤੇ ਹਿਟ ਰਹੀਆਂ ਹਨ ਅਤੇ ਇਨ੍ਹਾਂ ਨੇ ਬਹੁਤ ਹੀ ਦੌਲਤ ਸ਼ੌਹਰਤ ਕਮਾਈ ਹੈ ਉਹ ਇੱਕ ਬਹੁਤ ਚੰਗੇ ਵਿਅਕਤੀਤਵ ਦੇ ਮਾਲਕ ਹਨ ਉਹਨਾਂ ਨੂੰ ਦੁਨੀਆ ਨਾਲ ਇੰਨਾ ਕੋਈ ਵਾਸਤਾ ਨਹੀਂ ਹੈ ਆਪਣੀ ਦੁਨੀਆ ਵਿੱਚ ਹੀ ਮਸਤ ਰਹਿੰਦੇ ਹਨ ਅਤੇ ਆਪਣੇ ਕੰਮ ਨਾਲ ਉਹ ਵਾਸਤਾ ਰੱਖਦੇ ਹਨ ਅਤੇ ਰੱਬ ਦੀ ਰਜ਼ਾ ਵਿੱਚ ਰ ਰਾਜ਼ੀ ਰਹਿਣ ਵਾਲੇ ਵਿਅਕਤੀ ਹਨ ਅਤੇ ਇੱਕ ਮਸਤ ਪੰਜਾਬੀ ਹਨ ਜਿਵੇਂ ਕਿ ਪੰਜਾਬੀਆਂ ਦਾ ਇੱਕ ਵਿਵਹਾਰ ਹੁੰਦਾ ਹੈ ਧੰਨਵਾਦ ਜੀ